ਹੈਲੋ ਹਾਂਜੀ ਤੁਸੀਂ ਟਰਾਂਸਪੋਰਟ ਏਜੰਸੀ ਤੋਂ ਗੱਲ ਕਰ ਰਹੇ ਹੋ ਕੱਲ੍ਹ ਅਸੀਂ ਇੱਕ ਕੱਲ ਅਸੀਂ ਨੇੜਲੇ ਸ਼ਹਿਰ ਜਾਣ ਲਈ ਇੱਕ ਕੈਬ ਬੁੱਕ ਕੀਤੀ ਸੀ ਕੈਬ ਦੇ ਡਰਾਈਵਰ ਦਾ ਨਾਮ ਗੁਰਮੁਖ ਸਿੰਘ ਸੀ ਅਤੇ ਪਹਿਲਾਂ ਤਾਂ ਉਹ ਸਮੇਂ ਸਿਰ ਹੀ ਨਹੀਂ ਪਹੁੰਚੇ ਸਨ ਸਾਡੇ ਕੋਲ ਅਤੇ ਜਿਸ ਕਾਰਨ ਅਸੀਂ ਆਪਣੇ ਸ਼ਹਿਰ ਜਾਣ ਲਈ ਸਾਨੂੰ ਬਹੁਤ ਜ਼ਿਆਦਾ ਸਮਾਂ ਲੱਗ ਚੁੱਕਿਆ ਸੀ ਅਤੇ ਜਦੋਂ ਉਹ ਸਾਡੇ ਕੋਲ ਪਹੁੰਚੇ ਤਾਂ ਇੱਕ ਤਾਂ ਉਹਨਾਂ ਦਾ ਵਿਵਹਾਰ ਸਾਡੇ ਨਾਲ ਸਹੀ ਨਹੀਂ ਸੀ ਉਥੋਂ ਉਹਨਾਂ ਨੇ ਸਾਨੂੰ ਸਾਡੇ ਮਿੱਥੇ ਹੋਏ ਸਥਾਨ 'ਤੇ ਪਹੁੰਚਾ ਦਿੱਤਾ ਸੀ ਪਰ ਉਹਨਾਂ ਨੇ ਜਿੰਨੇ ਸਾਡੇ ਤੋਂ ਮੰਗ ਕੀਤੀ ਸੀ ਪੈਸਿਆਂ ਦੀ ਉਹਨਾਂ ਨੇ ਪਹਿਲਾਂ ਸਾਨੂੰ ਤਿੰਨ ਸੌ ਰੁਪਏ ਕਿਹਾ ਸੀ ਕਿ ਕਿਰਾਇਆ ਪਰ ਜਦੋਂ ਉਹਨਾਂ ਨੇ ਸਾਨੂੰ ਸਾਡੇ ਸੰਤ ਅਸਥਾਨ 'ਤੇ ਪਹੁੰਚਾਇਆ ਤਾਂ ਉਹਨਾਂ ਨੇ ਸਾਡੇ ਤੋਂ ਵੱਧ ਮੰਗ ਕੀਤੀ ਪੈਸਿਆਂ ਦੀ ਤਾਂ ਉਹ ਚਾਰ ਸੌ ਮੰਗਣ ਲੱਗ ਗਏ ਸੀ ਸਾ ਟਰਾਂਸਪੋਰਟ ਏਜੰਸੀ ਨਾਲ ਸਾਡੇ ਤੋਂ ਪਹਿਲਾਂ ਹੀ ਕਿਰਾਇਆ ਜੋ ਸੀ ਮਿੱਥਿਆ ਗਿਆ ਸੀ ਕਿ ਤਿੰਨ ਸੌ ਰੁਪਏ ਕਿਰਾਇਆ ਹੋਵੇਗਾ ਕੈਬ ਦਾ ਨੇੜਲੇ ਸ਼ਹਿਰ ਜਾਣ ਲਈ ਲੇਕਿਨ ਉਹ ਸਾਡੇ ਤੋਂ ਚਾਰ ਸੌ ਰੁਪਏ ਦੀ ਉਹਨਾਂ ਨੇ ਮੰਗ ਕੀਤੀ ਸੀ ਅਤੇ ਅਸੀਂ ਇਹਦਾ ਭੁਗਤਾਨ ਨਹੀਂ ਕਰਾਂਗੇ ਜੇਕਰ ਤੁਹਾਡੇ ਵੱਲੋਂ ਕਿਹਾ ਜਾਂਦਾ ਹੈ ਕਿ ਸਾਨੂੰ ਇਹਦਾ ਭੁਗਤਾਨ ਕਰਨਾ ਪਵੇਗਾ ਤਾਂ ਤੁਸੀਂ ਸਾਨੂੰ ਸਾਡੀ ਸ਼ਿਕਾਇਤ ਦਰਜ ਕਰੋ ਕਿ ਤੁਹਾਡੇ ਕੈਬ ਦੇ ਡਰਾਈਵਰ ਨੇ ਸਾਡੇ ਤੋਂ ਕਿਰਾਏ ਮਿੱਥੇ ਹੋਏ ਕਿਰਾਏ ਤੋਂ ਜ਼ਿਆਦਾ ਦੀ ਮੰਗ ਕੀਤੀ ਸੀ ਅਤੇ ਤੁਸੀਂ ਸਾਨੂੰ ਵਿਸ਼ਵਾਸ ਦਵਾਓ ਕਿ ਤੁਸੀਂ ਸਾਡਾ ਜਿਹੜਾ ਵੱਧ ਕਿਰਾਇਆ ਅਸੀਂ ਦਿੱਤਾ ਹੈ ਅਤੇ ਉਹ ਸਾਡਾ ਵਾਪਸ ਕੀਤਾ ਜਾਵੇਗਾ ਧੰਨਵਾਦ